ਹਾਂ ਨਿਊਸ ਮੀਡੀਆ ਨੇ ਮੇਰੇ ਕਾਰੋਬਾਰ ਨੂੰ ਵਧਾਉਣ ਵਿੱਚ ਬਹੁਤ ਮਦਦ ਕੀਤੀ ਹੈ ਖਾਸ ਕਰਕੇ ਮੈਂ ਇੱਕ ਖੇਤੀਬਾੜੀ ਨਾਲ ਸੰਬੰਧਿਤ ਪ੍ਰੋਗਰਾਮ ਦੇਖਦਾ ਹਾਂ ਜੋ ਮੈਨੂੰ ਨਵੀਆਂ ਤਕਨੀਕਾਂ ਅਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੰਦਾ ਹੈ ਇਸ ਤੋਂ ਇਲਾਵਾ ਮੈਂ ਇੱਕ ਮੈਗਜੀਨ ਵਿੱਚ ਵੀ ਪੜ੍ਹਦਾ ਹਾਂ ਜੋ ਛੋਟੇ ਕਾਰੋਬਾਰਾਂ ਲਈ ਵਿੱਤੀ ਸਲਾਹ ਦਿੰਦਾ ਹੈ ਇਨ੍ਹਾਂ ਸਰੋਤਾਂ ਨੇ ਮੈਨੂੰ ਆਪਣੇ ਕਾਰੋਬਾਰ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਵਿੱਚ ਬਹੁਤ ਹੀ ਜ਼ਿਆਦਾ ਮਦਦ ਕੀਤੀ ਹੈ